ਹਾਂਜੀ ਅੱਛਾ ਜੀ ਅੱਛਾ ਜੀ

ਕਦੋ ਲੈ ਗਏ ਸੀ ਅੱਛਾ ਜੀ

ਕੋਈ ਗੱਲ ਨੀ ਜੀ ਇਕ ਵਾਰੀ ਦੁਕਾਨ ਤੇ ਲੈ ਉਹ ਦੇਖ ਲਾਂਗੇ ਜੇ ਜੇ ਤਾਂ ਕੋਈ ਫੋਨ ਦੇ ਵਿੱਚ ਨੁਕਸ ਹੋਇਆ ਫਿਰ ਤਾ ਪਲੇਸਮੈਂਟ ਕਰ ਦਵਾਂਗੇ ਜੀ ਰਿਕੁਐਸਟ ਪਾ ਦਵਾਂਗੇ ਅੱਗੇ ਆਪਾਂ ਕੰਪਨੀ ਨੂੰ ਜੇ ਕਿਤੇ ਚਾਰਜਰ ਵਗੈਰਾ 'ਚ ਪ੍ਰੋਬਲਮ ਹੋਈ ਚਾਰਜਰ ਚੇਂਜ ਕਰ ਦਵਾਂਗੇ ਇਕ ਵਾਰ ਤੁਸੀਂ ਆ ਕੇ ਦੁਕਾਨ ਤੇ ਆ ਜਾਓ ਕੱਲ ਦੁਪਹਿਰ ਬਾਅਦ ਆ ਕੇ ਦੇਖ ਲਵਾਂਗੇ ਹਾਂਜੀ

ਅੱਛਾ ਜੀ ਕੋਈ ਗੱਲ ਨਹੀਂ ਦੇਖਦਾ ਇੱਕ ਵਾਰੀ ਚੈੱਕ ਕਰਕੇ ਦੇਖ ਲਵਾਂਗੇ ਪਤਾ ਲੱਗ ਜਾਊਗਾ ਵੈਸੇ ਗੱਲ ਗੁਲ ਸਹੀ ਕਰਵਾਉਂਦਾ ਜੀ ਅੱਛਾ ਜੀ

ਹਾਂਜੀ ਬਿੱਲ ਵਗੈਰਾ ਸਾਰਾ ਕੁਝ ਨਾਲ ਲੈ ਆਇਓ ਡੱਬਾ ਬਿੱਲ ਚਾਰਜਰ ਚੈੱਕ ਕਰਕੇ ਫਿਰ ਹੀ ਪਤਾ ਲੱਗੂਗਾ

ਹਾਂਜੀ ਬਸ ਜੇ ਤਾ ਚਾਰਜਰ ਦੀ ਪ੍ਰੋਬਲਮ ਹੋਈ ਮੈਂ ਤਾਂ ਫਿਰ ਚਾਰਜਰ ਚੇਂਜ ਹੋ ਜੁਗਾ ਜੀ ਠੀਕ ਹੈ ਜੇ ਫੋਨ ਦੀ ਪ੍ਰੋਬਲਮ ਹੋਈ ਤਾਂ ਕਿ ਆਪਣਾ ਕੰਪਨੀ ਗੱਲ ਕਰਾਂਗੇ ਉਹਨਾਂ ਰਿਕਵੈਸਟ ਪਾ ਦਵਾਂਗੇ ਫਿਰ ਦੇਖ ਲਾਂਗੇ ਜੇ ਚੇਂਜ ਹੁੰਦਾ ਹੋਇਆ ਤਾਂ ਫਿਰ ਚੇਂਜ ਕਰਵਾਦਾਂਗੇ ਠੀਕ ਹੈ ਓਕੇ